ਅੱਜ ਕੱਲ ਕਲਾਤਮਕ ਉਤਪਾਦਾਂ ਦਾ ਕਾਫੀ ਰੋਲਾ ਵਾਲਾ ਹੈ ਲੋਕਾਂ ਨੂੰ ਇਹ ਕਾਫੀ ਪਸੰਦ ਆਉਂਦੇ ਹੈ ਇਸਦੀ ਮੰਗ ਕਾਫੀ ਵੱਧ ਚੁੱਕੀ ਹੈ ਅਤੇ ਹਰ ਕੋਈ ਇਸ ਉਤਪਾਦ ਇਸ ਕਲਾਤਮਕ ਉਤਪਾਦਾਂ ਨੂੰ ਸਿੱਖਣਾ ਚਾਹੁੰਦਾ ਹੈ ਅਤੇ ਕਈ ਲੋਕ ਤਾਂ ਇਸਦਾ ਕੋਪੀਰਾਈਟ ਵੀ ਕਾਫੀ ਕਰਦੇ ਹਨ ਅਤੇ ਜੋ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਿਸ ਬੰਦੇ ਦੀ ਕਲਾ ਹੈ ਉਸ ਉਸਦਾ ਨਾਮ ਆਉਣਾ ਚਾਹੀਦਾ ਹੈ ਪਰ ਲੋਕ ਕੋਪੀਰਾਈਟ ਕਰਕੇ ਇਸਨੂੰ ਇਹ ਦਰਸਾਉਂਦੇ ਹਨ ਕਿ ਇਹ ਉਹਨਾਂ ਦੀ ਕਲਾ ਹੈ ਜੋ ਕਿ ਸਰਾਸਰ ਗਲਤ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਲਾ ਨੂੰ ਉਜਾਗਰ ਕਰਕੇ ਲੋਕ ਆਮ ਜਨਤਾ ਦੇ ਸਾਹਮਣੇ ਲੈ ਕੇ ਆਉਣ ਤਾਂ ਕਿ ਹੋਰ ਕਿਸੇ ਦੀ ਕਲਾ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ ਅਤੇ ਉਸ ਇਨਸਾਨ ਦੀ ਪ੍ਰਸ਼ੰਸਾ ਹੋਵੇ ਜਿਸ ਦੀ ਉਹ ਕਲਾ ਹੈ ਸਰਕਾਰ ਨੂੰ ਵੀ ਇਸ ਵਿੱਚ ਕਾਫੀ ਹੱਦ ਤੱਕ ਮਦਦ ਕਰਨੀ ਚਾਹੀਦੀ ਹੈ ਅਤੇ ਕੁਝ ਰੋਕ ਟੋਕ ਲਗਾਉਣੀ ਚਾਹੀਦੀ ਹੈ ਤਾਂ ਕਿ ਜਿਸ ਬੰਦੇ ਦੀ ਉਹ ਕਲਾ ਹੈ ਉਸ ਦਾ ਹੀ ਨਾਮ ਉਸਦਾ ਨਾਮ ਪਤਾ ਚੜ੍ਹੇ ਨਾ ਕਿ ਕਿਸੇ ਹੋਰ